ਹਾਂ ਬੈਂਕ ਬਾਰੇ ਮੇਰੇ ਕੁਝ ਮਾੜੇ ਅਨੁਭਵ ਰਹੇ ਹਨ ਬੈਂਂਕ ਦੇ ਸਭ ਤੋਂ ਮਾੜਾ ਅਨੁਭਵ ਇਹ ਹੈ ਕਿ ਕਈ ਵਾਰ ਬੈਂਕ ਦੇ ਸਟਾਫ਼ ਮੈਂਬਰਸ ਇੰਨੇ ਕੋਅਪ੍ਰੇਟਿਵ ਨਹੀਂ ਹੁੰਦੇ ਉਹ ਲੋਕਾਂ ਨਾਲ਼ ਇੰਨੀ ਵਧੀਆ ਤਰ੍ਹਾਂ ਗੱਲਬਾਤ ਨਹੀਂ ਕਰਦੇ ਅਤੇ ਜ਼ਿਆਦਾਤਰ ਉਹ ਬਜ਼ੁਰਗਾਂ ਅਤੇ ਅਨਪੜ੍ਹ ਲੋਕਾਂ ਨਾਲ਼ ਇੰਨੀ ਵਧੀਆ ਤਰ੍ਹਾਂ ਕੋਅਪਰੇਟ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਨਾਲ਼ ਚੰਗੀ ਤਰ੍ਹਾਂ ਗੱਲਬਾਤ ਕਰਦੇ ਨੇ ਇਸ ਤੋਂ ਇਲਾਵਾ ਬੈਂਕਾਂ ਦੇ ਵਿੱਚ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਰਕੇ ਲੋਕਾਂ ਨੂੰ ਘੰਟਾ ਘੰਟਾ ਵੇਟ ਕਰਨੀ ਪੈਂਦੀ ਹੈ ਉਹਨਾਂ ਨੂੰ ਆਪਣੇ ਹੀ ਪੈਸੇ ਕਢਵਾਉਣ ਲੱਗਿਆਂ ਛੱਤੀ ਸੌ ਕਾਗਜ਼ ਭਰਨੇ ਪੈਂਦੇ ਨੇ ਅਤੇ ਘੰਟਾ ਘੰਟਾ ਵੇਟ ਕਰਨੀ ਪੈਂਦੀ ਹੈ ਇਸ ਤੋਂ ਇਲਾਵਾ ਹਰ ਇੱਕ ਕੰਮ ਦਾ ਆਪਣਾ ਪ੍ਰੋਸੀਜਰ ਹੁੰਦਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਪੇਪਰ ਵਰਕ ਆਉਂਦਾ ਹੈ ਹਰ ਇੱਕ ਪ੍ਰੋਸੀਜਰ ਨੂੰ ਪੂਰਾ ਕਰਨ ਵਾਸਤੇ ਬਹੁਤ ਸਾਰਾ ਪੇਪਰ ਵਰਕ ਜਿਹੜਾ ਉਹ ਕੰਪਲੀਟ ਕਰਨਾ ਪੈਂਦਾ ਏ ਕੋਈ ਵੀ ਲੋਨ ਵਗੈਰਾ ਲੀਏ ਲੈਣਾ ਹੈ ਜਾਂ ਫਿਰ ਨਿਊ ਅਕਾਊਂਟ ਓਪਨ ਕਰਵਾਉਣਾ ਹੈ ਤਾਂ ਉਹਦੇ ਲਈ ਪਹਿਲਾਂ ਪੇਪਰ ਵਰਕ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ